ਪੰਜਾਬ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਆਰਟ ਗੈਲਰੀਆਂ ਜਾਂ ਅਜਾਇਬ ਘਰ ਹਨ ਜੋ ਕਿ ਸਾਡੀ ਰਾਜ ਦੀ ਕਲਾਤਮਕ ਵਿਰਾਸਤ ਨੂੰ ਪ੍ਰਦਸ਼ਿਤ ਕਰਦੇ ਹਨ ਜੋ ਕਿ ਸਾਡੇ ਵਿਰਸੇ ਨੂੰ ਅਸੀਂ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ ਉਹ ਪ੍ਰਦਰਸ਼ਿਤ ਕਰਦੇ ਹਨ ਪੰਜਾਬ ਵਿੱਚ ਪ੍ਰਮੁੱਖ ਆਰਟ ਗੈਲਰੀ ਜਿਸ ਜਿੱਦਾਂ ਕਿ ਗੌਰਮੈਂਟ ਕਾਲਜ ਆਫ ਆਰਟ ਚੰਡੀਗੜ੍ਹ ਮਿਊਜ਼ੀਅਮ ਕਲਾ ਮਿਊਜ਼ੀਅਮ ਇੱਦਾਂ ਹੋ ਇੱਦਾਂ ਹਨ ਇਸ ਤੋਂ ਇਲਾਵਾ ਅਜਾਇਬ ਘਰ ਜਿਵੇਂ ਕਿ ਸ਼੍ਰੀ ਅਨੰਦਪੁਰ ਸਾਹਿਬ ਅਜਾਇਬ ਘਰ ਹੈ ਸ਼੍ਰੀ ਅੰਮ੍ਰਿਤਸਰ ਅਜਾਇਬ ਘਰ ਹੈ ਇਸ ਤੋਂ ਇਲਾਵਾ ਸ਼੍ਰੀ ਤਰਨ ਤਾਰਨ ਤਰਨ ਤਾਰਨ ਸਾਹਿਬ ਵੀ ਅਜਾਇਬ ਘਰ ਹੈ ਚੰਡੀਗੜ੍ਹ ਵਿੱਚ ਚੰਡੀਗੜ੍ਹ ਵਿੱਚ ਅਜਾਇਬ ਘਰ ਮੌਜੂਦ ਹੈ ਜਿਸ ਦੇ ਵਿੱਚ ਅਸੀਂ ਆਪਣੀ ਵਿਰਸੇ ਨੂੰ ਅਤੇ ਕਲਾਤਮਕ ਵਿਰਾਸਤ ਨੂੰ ਕਿਵੇਂ ਸੰਭਾਲ ਸਕਦੇ ਹਾਂ ਉਸ ਬਾਰੇ ਦੱਸਿਆ ਗਿਆ ਹੈ ਜਿਸ ਵਿੱਚ ਸਾਡੇ ਪੁਰਾਣੇ ਵਿਰਸੇ ਦੇ ਵਿਅਕਤੀ ਜੋ ਕਿ ਸਾਡੇ ਵਿਰਸੇ ਨੂੰ ਜ਼ਿਆਦਾ ਵਰਤਦੇ ਸਨ ਉਹ ਉਹਨਾਂ ਦੀਆਂ ਮੂਰਤੀਆਂ ਲਾਈਆਂ ਗਈਆਂ ਹਨ ਜਿਸ ਦੇ ਵਿੱਚ ਅਲੱਗ ਤੋਂ ਇੱਕ ਟਿਕਟ ਰੱਖੀ ਗਈ ਹੈ ਜਿਸ ਲਈ ਅਸੀਂ ਆਪਣੇ ਫੰਡ ਵਗੈਰਾ ਵੀ ਦੇ ਸਕਦੇ ਹਾਂ ਜੋ ਕਿ ਇਹ ਇਹਨਾਂ ਪ੍ਰਦਰਸ਼ਨੀਆਂ ਦੁਆਰਾ ਸਰਕਾਰ ਦੁਆਰਾ ਫੰਡ ਦਿੱਤੇ ਜਾਂਦੇ ਹੈ ਇਸ ਨੂੰ ਅਸੀਂ ਵਿਜ਼ਿਟ ਕਰਨ ਲਈ ਕਿਸੇ ਦੀ ਜਗ੍ਹਾ ਜਿੱਦਾਂ ਕਿ ਜਿੱਥੇ ਮਿਊਜ਼ੀਅਮ ਜਾਂ ਅਜਾਇਬ ਘਰ ਬਣੇ ਹਨ ਉੱਥੇ ਜਾ ਜਾਂਦੇ ਹਾਂ ਪ੍ਰਮੁੱਖ ਆਰਟ ਗੈਲਰੀਆਂ ਵਿੱਚ ਅਤੇ ਅਜਾਇਬ ਘਰ ਜੋ ਕਿ ਸਾਡੀ ਵਿਰਾਸਤ ਨੂੰ ਅਤੇ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹਨ ਹੋ ਵੱਡਾ ਯੋਗ ਯੋਗਦਾਨ ਪਾਉਂਦੇ ਹਨ ਇਸ ਲਈ ਸਾਨੂੰ ਉੱਥੇ ਸਾਰਿਆਂ ਨੂੰ ਅਜਾਇਬ ਘਰ ਜਾਂ ਅੱਜ ਆਰਟ ਗੈਲਰੀਆਂ ਨੂੰ ਘੁੰਮਣਾ ਫਿਰਨਾ ਅਤੇ ਉਸ ਬਾਰੇ ਆਪਣੇ ਵਿਰਸੇ ਅਸੀਂ ਵਿਰਸੇ ਨੂੰ ਕਿਵੇਂ ਸੰਭਾਲ ਸਕਦੇ ਹਾਂ ਉਸ ਬਾਰੇ ਸਿੱਖਣਾ ਚਾਹੀਦਾ ਹੈ